ਹਾਂਜੀ ਭਾਅ ਜੀ ਮੈਂ ਅਸੀਂ ਹੁਣ ਤੁਹਾਡੀ ਕਨਵੈਂਸ 'ਚ ਆ ਤਾਂ ਗਏ ਆ ਪਰ ਸਾਡੇ ਕੋਲ ਹੁਣ ਮੇਰੇ ਕੋਲ ਕੈਸ਼ ਇਸ ਟਾਈਮ ਨਹੀਂ ਹੈਗਾ ਤੇ ਤੁਹਾਡਾ ਕੋਈ ਯੂ ਪੀ ਆਈ ਨੰਬਰ ਹੈਗਾ ਮੈਂ ਤੁਹਾਨੂੰ ਉਹਦੀ ਪੇਮੈਂਟ ਜਿਹੜੀ ਐ ਤੁਹਾਨੂੰ ਮੈਂ ਯੂ ਪੀ ਆਈ ਨੰਬਰ ' ਤੇ ਕਰ ਦਿੰਦੀ ਆ ਅੱਛਾ ਤੁਹਾਡੇ ਕੋਲ ਯੂ ਪੀ ਆਈ ਨੰਬਰ ਨਹੀਂ ਹੈਗਾ ਪਰ ਯੂ ਪੀ ਆਈ ਆਈਡੀ ਹੋਏਗੀ ਤੁਹਾਡੀ ਅੱਛਾ ਤੁਸੀਂ ਤੁਹਾਨੂੰ ਨਹੀਂ ਚਲਾਉਣੀ ਆਉਂਦੀ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਫੋਨ 'ਚ ਆਪਣੇ ਗੂਗਲ ਪੇਅ ਜਾਂ ਫੋਨਪੇਅ ਕੋਈ ਐਪ ਜਿਹੜਾ ਉਹ ਹੈਗਾ ਉਹਨੂੰ ਖੋਲ੍ਹੋ ਉਹਨੂੰ ਖੋਲ੍ਹਣ ਤੋਂ ਬਾਅਦ ਮੈਂ ਤੁਹਾਨੂੰ ਇੱਧਰੋਂ ਪੈਸੇ ਸੈਂਡ ਕਰਾਂਗੀ ਤੁਹਾਡੇ ਜਿੰਨੇ ਪੈਸੇ ਬਣਦੇ ਨੇ ਤੁਸੀਂ ਮੈਨੂੰ ਦੱਸਦੋ ਅਤੇ ਮੈਂ ਤੁਹਾਡੇ ਉਨੇ ਪੈਸੇ ਸੈਂਡ ਕਰ ਦਾਂਗੀ ਤੁਸੀਂ ਉੱਧਰ ਰਿਸੀਵ ਦਾ ਬਟਨ ਆਏਗਾ ਉਹ 'ਤੇ ਤੁਸੀਂ ਓਕੇ ਕਰਨਾ ਅਤੇ ਤੁਹਾਡੇ ਪੈਸੇ ਤੁਹਾਡੇ ਅਕਾਊਂਟ 'ਚ ਆ ਜਾਣਗੇ ਅਤੇ ਤੁਹਾਨੂੰ ਮੈਸੇਜ ਆ ਜਾਏਗਾ ਚਲੋ ਤੁਸੀਂ ਇਹ ਕਰੋ ਅਤੇ ਉਸ ਤੋਂ ਬਾਅਦ ਤੁਹਾਡਾ ਹਾਂਜੀ ਓਪਨ ਹੋ ਗਿਆ ਉਸ ਤੋਂ ਓਪਨ ਹੋਣ ਤੋਂ ਬਾਅਦ ਤੁਸੀਂ ਮੈਂ ਇੱਧਰੋਂ ਕਰਤੇ ਸੈਂਡ ਤੁਹਾਨੂੰ ਹੁਣ ਤੁਸੀਂ ਰਿਸੀਵ ਬਟਨ ਓਕੇ ਕਰੋ ਮੈਸੇਜ ਆ ਗਿਆ ਤੁਹਾਡੀ ਪੇਮੈਂਟ ਤੁਹਾਡੇ ਅਕਾਊਂਟ 'ਚ ਆ ਚੁੱਕੀ ਹੈ ਇੱਦਾਂ ਹੀ ਬਸ ਯੂਜ ਕਰੀਦਾ ਔਨਲਾਈਨ ਯੂ ਪੀ ਆਈ ਨੰਬਰ ਠੀਕ ਹੈ ਜੀ ਧੰਨਵਾਦ ਜੀ